ਹਾਂਜੀ ਮੈਂ ਕਿਸੇ ਟਾਈਮ ਸੰਗਠਿਤ ਬਾਈਕਿੰਗ ਸਮਾ ਸਮਾਗਮਾਂ ਜਾਂ ਰੇਸਾਂ ਦੇ ਵਿੱਚ ਹਿੱਸਾ ਲਿਆ ਸੀ ਕਿਉਂਕਿ ਮੈਨੂੰ ਬਾਈਕ ਚਲਾਉਣੀ ਮੋਟਰਸਾਇਕਲ ਚਲਾਉਣਾ ਰੇਸਾਂ ਲਗਾਉਣੀਆਂ ਮੈਨੂੰ ਕਾਫੀ ਅੱਛੀਆਂ ਲੱਗਦੀਆਂ ਸੀ ਅੱਜ ਦੇ ਟਾਈਮ ਦੇ ਵਿੱਚ ਯਾਮਾ ਦੀ ਬਾਈਕ ਵਗੈਰਾ ਦੀ ਕਾਫੀ ਜ਼ਿਆਦਾ ਰੇਸਿੰਗ ਚਲਦੀ ਰਹਿੰਦੀ ਹੈ ਮੈਂ ਉਹ 'ਤੇ ਭਾਗ ਲੈਂਦਾ ਰਹਿੰਦਾ ਹਾਂ ਅਤੇ ਮੈਨੂੰ ਉਹ 'ਤੇ ਭਾਵੇਂ ਮੈਂ ਸੈਕਿੰਡ ਆਇਆ ਸਾਂ ਪਰ ਮੈਨੂੰ ਕਾਫੀ ਅੱਛਾ ਫੀਲ ਹੋਇਆ ਅਤੇ ਮੈਂ ਅੱਜ ਦੇ ਟਾਈਮ ਦੇ ਵਿੱਚ ਮੋਟਰਸਾਈਕਲ ਰੱਖਿਆ ਹੋਇਆ ਹੈ ਸਪਲੈਂਡਰ ਪਰ ਮੈਂ ਅਗਲੇ ਟਾਈਮ ਦੇ ਵਿੱਚ ਯਾਮਾ ਦੀ ਹੀ ਬਾਈਕ ਲੈਣਾ ਚਾਹਾਂਗਾ ਕਿਉਂਕਿ ਮੈਨੂੰ ਯਾਮਾ ਦਾ ਇੱਕ ਪੁਰਾਣਾ ਬਾਈਕ ਆਉਂਦਾ ਹੁੰਦਾ ਸੀ ਯਾਮਾ ਆਰ ਐਕਸ ਹੰਡਰਡ ਉਹ ਲੈਣ ਦਾ ਚਾਹਵਾਨ ਹਾਂ ਪਰ ਉਹ ਕੰਪਨੀ ਆਉਣ ਵਾਲੇ ਸਾਲ ਦੋ ਸਾਲ ਦੇ ਵਿੱਚ ਉਹ ਕੱਢਣ ਦੁਬਾਰਾ ੲ ਲੋਂਚ ਕਰਨ ਜਾ ਰਹੀ ਹੈ ਅਤੇ ਮੈਂ ਉਹੀ ਬਾਈਕ ਲੈ ਕੇ ਦੁਬਾਰਾ ਫਿਰ ਇਸੇ ਰੇਸਿੰਗ ਦੇ ਵਿੱਚ ਜਾਣਾ ਚਾਹਾਂਗਾ ਨਾਲੇ ਮੈਂ ਇੱਕ ਟੂਰ ਲਗਾਉਣਾ ਚਾਹਾਂਗਾ ਜਿੱਦਾਂ ਲੇਹ ਲਦਾਖ ਦਾ ਬਾਈਕ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਮੇਰਾ ਇੱਕ ਖ਼ਵਾਬ ਹੈ ਧੰਨਵਾਦ ਜੀ